ਹਾਂਜੀ ਮੈਂ ਆਪਣੇ ਸਕੂਲ ਵਿੱਚ ਇੱਕ ਵਾਰ ਪੇਂਟਿੰਗ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀਗਾ ਜਿਸ ਵਿੱਚ ਮ ਮਦਰਜ਼ ਡੇ ਦੇ ਉੱਤੇ ਮੈਂ ਆਪਣੀ ਮਾਂ ਦੇ ਮਾਂ ਦਾ ਚਿੱਤਰ ਦਰਸਾਉਂਦੇ ਹੋਏ ਪੇਂਟਿੰਗ ਕੀਤੀ ਸੀਗੀ ਅਤੇ ਉਸ ਪੇਂਟਿੰਗ ਲਈ ਮੈਨੂੰ ਅਵਾਰਡ ਵੀ ਮਿਲਿਆ ਸੀ